ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਆ ਸਾਰੇ ਹਾਂ ਹਾਂ ਹਾਂ ਬਹੁਤ ਵਧੀਆ ਵਧੀਆ ਜੀ ਕਿਵੇਂ ਯਾਦ ਕੀਤਾ ਕਦੋਂ ਅੱਛਾ ਕਰਾਏ 'ਤੇ ਇੱਥੇ ਆਪਣਾ ਨੇੜੇ ਆਏ ਆ ਅੱਛਾ ਜੀ ਅੱਛਾ ਸਬਜ਼ੀਆਂ ਬਾਰੇ ਅੱਛਾ ਠੀਕ ਹੈ ਠੀਕ ਹੈ ਤੁਹਾਨੂੰ ਡਰੈਸਾਂ ਦਾ ਪਤਾ ਨਹੀਂ ਨਾ ਨਵੇਂ ਆਏ ਆ ਅਸੀਂ ਤਾਂ ਫਿਰ ਇੱਥੇ ਜੱਦੀ ਪੁਰਾਣੇ ਬਹੁਤ ਚਿਰ ਦੇ ਰਹਿੰਦੇ ਹਾਂ ਸਾਨੂੰ ਤਾਂ ਪਤਾ ਵੀ ਕਿੱਥੇ ਸਬਜ਼ੀ ਆਉਂਦੀ ਆ ਕਿੱਥੇ ਬਾਹਲੀ ਹੈ ਕਿੱਥੇ ਘੱਟ ਆ ਗਲੀਆਂ 'ਚ ਕਿੱਥੇ ਆਉਂਦੀ ਆ ਤਾਂ ਜ਼ਰੂਰ ਦੱਸਾਂਗੇ ਜੇ ਪੁੱਛੋ ਹਾਂ ਹਾਂ ਠੀਕ ਹੈ ਜੀ ਠੀਕ ਹੈ ਜੀ ਉਹ ਸਬਜ਼ੀ ਅਸੀਂ ਤੁਹਾਨੂੰ ਪੱਕਾ ਡਰੈਸ ਹੀ ਦੱਸ ਦਿੰਦੇ ਹਾਂ ਬਈ ਪੁਰਾਣੀ ਦਾਣਾ ਮੰਡੀ ਕੋਲੇ ਇੱਕ ਮੰਡੀ ਆ ਸਬਜ਼ੀ ਮੰਡੀ ਉਹ ਖੇਤਾਂ ਦੇ ਵਿੱਚ ਉਹ ਖੇਤਾਂ ਦੇ ਵਿੱਚੋਂ ਲੋਕ ਸਵੇਰੇ ਚਾਰ ਵਜੇ ਉੱਥੇ ਆਪਣੇ ਖੇਤਾਂ ਦੀ ਸਬਜ਼ੀ ਲੈ ਕੇ ਆਉਂਦੇ ਆ ਅਤੇ ਉਹ ਮੰਡੀ ਦੇ ਵਿੱਚ ਆ ਕੇ ਵੇਚਦੇ ਆ ਉਥੋਂ ਜਿੰਮੀਦਾਰ ਜਿੰਨੇ ਵੀ ਉਹ ਸਬਜ਼ੀ ਵਧੀਆ ਤੋਂ ਵਧੀਆ ਲਿਆ ਕੇ ਉੱਥੇ ਕਹਿੰਦੇ ਲੋਕ ਬਹੁਤ ਸਵੇਰੇ ਉੱਥੇ ਜਾ ਕੇ ਸੁਬਹ ਸੁਬਹ ਬਹੁਤ ਸਬਜ਼ੀ ਵਧੀਆ ਲੈ ਕੇ ਆਉਂਦੇ ਆ ਅਤੇ ਉਥੋਂ ਮੰਡੀ ਦੇ ਵਿੱਚ ਇੱਕ ਆਪਣੇ ਥਾਣਾ ਸਿਟੀ ਕੋਲੇ ਪਾਰਕ ਹੈ ਇ ਇੱਥੇ ਵੀ ਬ ਜਿੰਮੀਦਾਰ ਰੇੜੀਆਂ ਲਾਉਂਦੇ ਆ ਆਪਣੀ ਸਬਜ਼ੀ ਵੇਚਦੇ ਆ ਲਿਆ ਕੇ ਤੁਸੀਂ ਇੱਥੋਂ ਵੀ ਲੈ ਸਕਦੇ ਹੋ ਹਾਂ ਹਾਂ ਫਰੂਟ ਵੀ ਮੰਡੀ 'ਚ ਵੀ ਫਰੂਟ ਵਾਧੂ ਆਉਂਦਾ ਅਤੇ ਇੱਥੇ ਪਾਰਕ ਦੇ ਵਿੱਚ ਵੀ ਫਰੂਟ ਬਹੁਤ ਆਉਂਦਾ ਅਤੇ ਹਾਂ ਵਧੀਆ ਉਹ ਆਉਂਦੀਆਂ ਜੀ ਜਿਵੇਂ ਮੰਡੀ ਦੇ ਵਿੱਚੋਂ ਲੋਕਾਂ ਨੇ ਸਵੇਰੇ ਉਹ ਸਬਜ਼ੀ ਖਰੀਦ ਲੈਂਦੇ ਆ ਨਾ ਅਤੇ ਉਹ ਵੀ ਉੱਥੋਂ ਉਹ ਵੀ ਉੱਥੋਂ ਜਿਮੀਦਾਰਾਂ ਤੋਂ ਰੇੜੀਆਂ ਭਰ ਕੇ ਲਿਆ ਕੇ ਆਪਣੇ ਨੌ ਦਸ ਵਜੇ ਗਲੀਆਂ ਦੇ ਵਿੱਚ ਹੋ ਕੇ ਦੇਣੇ ਸ਼ੁਰੂ ਕਰ ਦਿੰਦੇ ਆ ਵੀ ਆਹ ਤਾਜ਼ੀ ਸਬਜ਼ੀ ਲੈ ਲਓ ਵੀ ਅਸੀਂ ਲੈ ਕੇ ਆਏ ਹਾਂ ਅਤੇ ਉਹ ਲੋਕ ਜਿਹਨਾਂ ਤੋਂ ਨਹੀਂ ਆਇਆ ਜਾਂਦਾ ਉੱਥੇ ਮੰਡੀ ਦੇ ਵਿੱਚ ਉਹ ਆਪਣਾ ਰੇੜੀਆ ਤੋਂ ਲੈ ਲੈਂਦੇ ਆ ਸਬਜ਼ੀ ਅਤੇ ਫਿਰ ਆਪਣੇ ਰੇੜੀਆਂ ਬਹੁਤ ਆਉਂਦੀਆਂ ਨੌਂ ਵਜੇ ਤੋਂ ਬਾਅਦ ਚਾਲੂ ਵਾਧੂ ਹੋ ਜਾਂਦੀਆਂ ਹਾਂ ਸਾਨੂੰ ਤਾਂ ਪਤਾ ਹੀ ਪਲ ਪਲ ਦਾ ਹਾਂ ਜਾ ਦੋ ਚਾਰ ਵਾਰੀ ਤੁਸੀਂ ਆਪੇ ਗਏ ਆਪੇ ਜਾਣੂ ਹੋ ਜੂਗੇ ਤੁਸੀਂ ਆਏ ਆ ਬਾਹਰੋਂ ਨਹੀਂ ਪਤਾ ਲੱਗਦਾ ਹੁਣ ਤੁਹਾਨੂੰ ਦੱਸਾਂਗੇ ਤੁਸੀਂ ਆਪੇ ਪਤਾ ਲੱਗਜੂ ਵੀ ਕਿੱਥੋਂ ਵਧੀਆ ਸਬਜ਼ੀ ਮਿਲਦੀ ਹੈ ਕਿੱਥੋਂ ਤਾਜ਼ੀ ਮਿਲਦੀ ਹੈ ਕਿੱਥੋਂ ਦੇਸੀ ਮਿਲਦੀ ਹੈ ਜਿਮੀਦਾਰਾਂ ਵਾਲੀ ਜ਼ਰੂਰ ਜੀ ਜ਼ਰੂਰ

ਸਤਿ ਸ਼੍ਰੀ ਅਕਾਲ ਜੀ